ਪੰਜਾਬ ਵਿੱਚ ਜ਼ਿਆਦਾਤਰ ਜੋ ਭਾਸ਼ਾ ਬੋਲੀ ਜਾਂਦੀ ਹੈ ਉਹ ਪੰਜਾਬੀ ਹੈ ਔਰ ਬਾਕੀ ਭਾਸ਼ਾਵਾਂ ਵੀ ਇਸਦੇ ਨਾਲ ਨਾਲ ਵਿਕਸਿਤ ਹੋ ਰਹੀਆਂ ਹਨ